ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਗੁਰੂ ਨਾਨਕ ਸਟਿਲ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਇੱਕ ਸਟੋਵ ਔਰਡਰ ਕੀਤਾ ਸੀਗਾ ਜਿਹੜਾ ਕਿ ਤੁਸੀਂ ਮੈਨੂੰ ਮਤਲਬ ਅਠਾਰਾਂ ਤਰੀਕ ਨੂੰ ਕਿਹਾ ਸੀਗਾ ਮਤਲਬ ਡਿਲੀਵਰੀ ਲਈ ਪਰ ਉਹ ਮੈਨੂੰ ਉਹ ਤੋਂ ਪਹਿਲਾਂ ਹੀ ਰਿਸੀਵ ਹੋ ਗਿਆ ਪਹਿਲਾਂ ਤਾਂ ਤੁਹਾਡੇ ਲਿਵਰੀ ਲਈ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਮੈਨੂੰ ਟਾਈਮ ਤੋਂ ਪਹਿਲਾਂ ਹੀ ਕੀ ਹੈ ਮੇਰੇ ਕੋਲ ਪ ਪੁੱਜਦਾ ਕਰਤਾ ਅਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਪੈਕਿੰਗ ਕਰਕੇ ਦਿੱਤੀ ਸੀ ਉਹ ਬਹੁਤ ਜ਼ਿਆਦਾ ਵਧੀਆ ਕਰਕੇ ਦਿੱਤੀ ਸੀ ਕਿ ਸਟੋਵ ਮੈਨੂੰ ਐਵੇਂ ਸੀ ਮੇਰੇ ਕੋਲ ਪੂਰਾ ਪਹੁੰਚਣਾ ਹੀ ਨਹੀਂ ਬਟ ਉਹ ਸਟੋਵ ਦੀ ਤੁਸੀਂ ਪੈਕਿੰਗ ਐਨੀ ਵਧੀਆ ਢੰਗ ਨਾਲ ਕੀਤੀ ਸੀ ਕਿ ਉਹ ਮੇਰੇ ਕੋਲ ਵਧੀਆ ਪ੍ਰੋਪਰ ਵਧੀਆ ਢੰਗ ਨਾਲ ਪਹੁੰਚ ਗਿਆ ਅਤੇ ਉਹ ਸਟੋਵ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀਗੀ ਕਿ ਮੈਨੂੰ ਮਤਲਬ ਕਿ ਜਿਹੜੀ ਤੁਸੀਂ ਫੋਟੋ ਭੇਜੀ ਸੀ ਉਹਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਲੱਗਿਆ ਦੇਖਣ 'ਚ ਵੀ ਬਹੁਤ ਜ਼ਿਆਦਾ ਵਧੀਆ ਸੀ ਅਤੇ ਉਹ ਮਤਲਬ ਕਿ ਮਤਲਬ ਜਿਹੜਾ ਉਹ ਕੰਮ ਕਰ ਰਿਹਾ ਉਹ ਵੀ ਬਹੁਤ ਵਧੀਆ ਸੀ ਅਤੇ ਜਿਹੜੀ ਤੁਹਾਡੀ ਮਤਲਬ ਕਿ ਡਿਲੀਵਰੀ ਟਾਈਮ ਤੁਸੀਂ ਆਪਣੇ ਨਾਲ ਉਹਦੇ ਸਟੋਵ ਦੇ ਸਟੈਪ ਤੁਸੀਂ ਭੇਜੇ ਹੋਏ ਸੀਗੇ ਵੀ ਕ ਕਿੱਦਾਂ ਇਹਨੂੰ ਲਗਾਉਣਾ ਕਿੱਦਾਂ ਇਹਨੂੰ ਚਲਾਉਣਾ ਉਹ ਵੀ ਬਹੁਤ ਵਧੀਆ ਸੀਗਾ ਕਿ ਸਾਨੂੰ ਸਮਝਣ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਮਦਦ ਮਿਲੀ ਉਸ ਤੁਹਾਡੀ ਬੁਕਲੈਟ ਦੇ ਨਾਲ ਅਤੇ ਕੀ ਨਾਮ ਹੈ ਸਟੋਵ ਕੀ ਹੈ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਕੰਮ ਕਰ ਰਿਹਾ ਅਤੇ ਉਹਦੀ ਦੇਖਣ ਮਤਲਬ ਉਹਦਾ ਕਲਰ ਵੀ ਜਿਹੜਾ ਤੁਸੀਂ ਭੇਜਿਆ ਬਹੁਤ ਜ਼ਿਆਦਾ ਵਧੀਆ ਹੈਗਾ ਮੇਰੀ ਇਮੈਜੀਨੇਸ਼ਨ ਤੋਂ ਜ ਕਿਤੇ ਹੀ ਜ਼ਿਆਦਾ ਵਧੀਆ ਕੰਮ ਕਰ ਰਿਹਾ ਅਤੇ ਕਿਤੇ ਹੀ ਜ਼ਿਆਦਾ ਵਧੀਆ ਦੇਖਣ ਦੇ ਵਿੱਚ ਲੱਗਿਆ ਭਾਅ ਜੀ ਤੁਹਾਡਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ